ਲਾਈਟ ਵੈਸੇ ਤਾਂ ਗਰਮੀਆਂ ਸਰਦੀਆਂ ਦੋਨਾਂ 'ਚ ਜਾਂਦੀ ਹੈ ਗਰਮੀਆਂ ਦੇ ਵਿੱਚ ਸਾਨੂੰ ਲਾਈਟ ਦੀ ਬਹੁਤ ਹੀ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਕਿਉਂਕਿ ਗਰਮੀਆਂ ਦੇ ਵਿੱਚ ਫਿਰ ਪੱਖੇ ਏਸੀ ਵਗੈਰਾ ਸਾਰੇ ਬੰਦ ਹੋ ਜਾਂਦੇ ਹਨ ਜਿਸ ਦੇ ਨਾਲ ਫਿਰ ਬੱਚਿਆਂ ਨੂੰ ਵੱਡਿਆਂ ਨੂੰ ਬਜ਼ੁਰਗਾਂ ਨੂੰ ਸਭ ਨੂੰ ਬਹੁਤ ਗਰਮੀ ਲੱਗਦੀ ਹੈ ਅਤੇ ਉਸ ਕਰਕੇ ਸਾਨੂੰ ਫਿਰ ਬਹੁਤ ਹੀ ਜ਼ਿਆਦਾ ਮੁਸ਼ਕਿਲ ਅਤੇ ਗਰਮੀਆਂ ਦੇ ਵਿੱਚ ਕੱਟ ਵੀ ਬਹੁਤ ਜ਼ਿਆਦਾ ਲੱਗਦੇ ਹਨ ਬੱਚਿਆਂ ਨੂੰ ਜਿੱਦਾਂ ਸਵੇਰੇ ਸਕੂਲ ਜਾਣਾ ਹੁੰਦਾ ਹੈ ਫਿਰ ਉਹਨਾਂ ਨੂੰ ਬਹੁਤ ਮੁਸ਼ਕਿਲ ਆਉਂਦੀ ਤਿਆਰ ਕਰਨਾ ਬੱਚਿਆਂ ਨੂੰ ਸਕੂਲ ਭੇਜਣਾ ਫਿਰ ਫਰਿੱਜ ਦੇ ਵਿੱਚ ਵੀ ਸਾਰਾ ਸਮਾਨ ਸਾਡਾ ਫਿਰ ਖਰਾਬ ਹੋ ਜਾਂਦਾ ਹੈ ਆਟਾ ਵਗੈਰਾ ਦੁੱਧ ਵਗੈਰਾ ਵੀ ਕਈ ਵਾਰੀ ਖਰਾਬ ਹੁੰਦਾ ਕਿਉਂਕਿ ਕਈ ਵਾਰੀ ਗਰਮੀਆਂ ਦੇ ਵਿੱਚ ਬਿਜਲੀ ਦੇ ਬਹੁਤ ਜ਼ਿਆਦਾ ਕੱਟ ਲੱਗਣ ਕਰਕੇ ਸਾਨੂੰ ਫਿਰ ਬਹੁਤ ਹੀ ਜ਼ਿਆਦਾ ਮੁਸ਼ਕਿਲ ਆਉਂਦੀ ਹੈ ਅਤੇ ਸਰਦੀਆਂ ਦੇ ਵਿੱਚ ਵੀ ਵੈਸੇ ਤਾਂ ਸਾਨੂੰ ਪਾਣੀ ਦੀ ਬਹੁਤ ਮੁਸ਼ਕਿਲ ਆਉਂਦੀ ਮਤਲਬ ਆਉਂਦੀ ਫਿਰ ਪਾਣੀ ਵੀ ਨਹੀਂ ਆਉਂਦਾ ਪਾਣੀ ਪਾਣੀ ਵੀ ਨਹੀਂ ਆਉਂਦਾ ਹੈਗਾ ਫਿਰ ਸਾਨੂੰ ਮਤਲਬ ਫਿਰ ਪਾਣੀ ਤੋਂ ਬਗੈਰ ਘਰ 'ਚ ਕੋਈ ਕੰਮ ਨਹੀਂ ਹੁੰਦਾ ਨਾ ਕੋਈ ਫਿਰ ਅਸੀਂ ਕੋਈ ਖਾਣਾ ਵਗੈਰਾ ਬਣਾ ਸਕਦੇ ਹਾਂ ਉਹਦੇ ਕਰਕੇ ਸਾਨੂੰ ਫਿਰ ਜਿੱਦਾਂ ਕਿ ਫਿਰ ਗੀ ਗੀਜਰ ਵੀ ਨਹਾਉਣਾ ਵੀ ਸਾਨੂੰ ਬਹੁਤ ਮੁਸ਼ਕਿਲ ਹੋ ਜਾਂਦਾ ਗੀਜਰ ਚਲਾਉਣਾ ਵੀ ਸਾਨੂੰ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ ਉਸ ਤੋਂ ਬਗੈਰ ਫਿਰ ਬੱਚਿਆਂ ਨੂੰ ਨਵਾਣਾ ਧਵਾਣਾ ਬਹੁਤ ਹੀ ਮੁਸ਼ਕਿਲ ਗੱਲ ਹੋ ਜਾਂਦੀ ਹੈ ਅਤੇ ਇਸ ਕਰਕੇ ਬਿਜ ਇਸ ਕਰਕੇ ਬਿਜਲੀ ਦੇ ਬਹੁਤ ਜ਼ਿਆਦਾ ਕੱਟ ਲੱਗਦੇ ਹਨ ਸਾਨੂੰ ਬਹੁਤ ਜ਼ਿਆਦੀਆਂ ਹੀ ਪ੍ਰੋਬਲਮਾਂ ਆਉਂਦੀਆਂ ਨੇ ਪਾਣੀ ਤੋਂ ਬਗੈਰ ਤਾਂ ਇੱਕ ਮਿੰਟ ਵੀ ਨਹੀਂ ਸਰਦਾ ਬਜ਼ੁਰਗਾਂ ਨੂੰ ਗਰਮੀ ਜ਼ਿਆਦਾ ਲੱਗਦੀ ਹੈ ਬੱਚਿਆਂ ਨੂੰ ਗਰਮੀ ਬਹੁਤ ਲੱਗਦੀ ਹੈ ਰਸੋਈ ਦੇ ਵਿੱਚ ਕੰਮ ਕਰਨਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ ਅਤੇ ਮਤਲਬ ਕਿ ਪਾਣੀ ਦੀ ਸਭ ਤੋਂ ਜ਼ਿਆਦਾ ਦਿੱਕਤ ਸਾਨੂੰ ਪਾਣੀ ਦੀ ਹੀ ਆਉਂਦੀ ਹੈ ਪਾਣੀ ਤੋਂ ਬਗੈਰ ਤਾਂ ਕੋਈ ਕੰਮ ਨਹੀਂ ਕਰਦਾ ਕੋਈ ਕੰਮ ਨਹੀਂ ਨਾ ਖਾਣਾ ਬਣਾ ਸਕਦੇ ਅਸੀਂ ਨਾ ਅਸੀਂ ਕੁਛ ਵੀ ਨਹੀਂ ਕਰ ਸਕਦੇ ਅਸੀਂ ਅਤੇ ਇਸ ਕਰਕੇ ਸਾਨੂੰ ਪਾਣੀ ਦੀ ਬਹੁਤ ਹੀ ਜ਼ਿਆਦਾ ਮੁਸ਼ਕਿਲ ਆਉਂਦੀ ਹੈ